ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਸਾਡੇ ਕੋਲ ਦੋਵੇਂ ਕੁਆਲਿਟੀਜ ਅਵੇਲੇਬਲ ਨੇ ਜੈਂਟਸ ਵੀ ਲੇਡੀਜ ਵੀ ਹਾਂਜੀ ਹਾਂਜੀ ਮਿਲ ਜਾਣਗੇ ਸਾਈਜ਼ ਛੇ ਸਿਕਸ ਨੰਬਰ ਤੋਂ ਸਟਾਰਟ ਹੋ ਜਾਂਦਾ ਹੈ ਅਤੇ ਟੈੱਨ ਇਲੈਵਨ ਤੱਕ ਅਵੇਲਬਲ ਰਹੇਗਾ ਹਾਂਜੀ ਹਾਂਜੀ ਸਾਰੇ ਲੇਡੀਜ 'ਚ ਸਿਕਸ ਤੋਂ ਸਟਾਰਟ ਮਿਲ ਜੇਗਾ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੈਂਟਸ ਵਾਲਾ ਵੀ ਮਿਲ ਜੇਗਾ ਟੋਟਲੀ ਸਾਰਾ ਜੈਂਟਸ ਦਾ ਵੀ ਸਿਕਸ ਤੋਂ ਸਟਾਰਟ ਹੋ ਜੇਗਾ ਸ਼ਾਪ ਦੀ ਟਾਈਮਿੰਗ ਸਵੇਰੇ ਨੌ ਤੋਂ ਰਾਤ ਨੂੰ ਨੌ ਵਜੇ ਤੱਕ ਹਾਂਜੀ ਹਾਂਜੀ ਹਾਂਜੀ ਹਾਂਜੀ ਫੋਟੋ 'ਚ ਭੇਜ ਦਾਂਗੇ ਬਾਕੀ ਮੈਪ 'ਤੇ ਵੀ ਲੋਕੇਸ਼ਨ ਹੈ ਜੀ ਉੱਹਦੇ 'ਤੇ ਸਰਚ ਕਰਕੇ

ਹਾਂਜੀ ਹਾਂਜੀ ਹਾਂ ਜ਼ਰੂਰ ਆ ਓਕੇ ਜੀ ਓਕੇ